ਤੁਹਾਡੇ ਸ਼ੌਕ ਨਾਲ ਤੁਸੀਂ ਕਿ ਚਾਹੁੰਦੇ ਹਾਂ ਵੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਕੋਈ ਫਾਇਦਾ ਹੋਵੇ ਸ਼੍ਰੀਮਾਨ ਮੇਰੇ ਦੋ ਮੁੱਖ ਸ਼ੌਂਕ ਨੇ ਇੱਕ ਤਾਂ ਹੈ ਲਿਖਣਾ ਅਤੇ ਦੂਜਾ ਪੜ੍ਹਨਾ ਮੈਂ ਚਾਹੁੰਦਾ ਹਾਂ ਕਿ ਮੈਂ ਵਿਸ਼ਵ ਦਾ ਸਾਹਿਤ ਪੰਜਾਬੀ ਵਿੱਚ ਅਨੁਵਾਦ ਕਰਾਂ ਤਾਂ ਜੋ ਪੀੜ੍ਹੀਆਂ ਨੂੰ ਸਮੂਹ ਚੇਤਨਾ ਜਾਂ ਸੰਸਾਰਕ ਚੇਤਨਾ ਬਾਰੇ ਪਤਾ ਲੱਗ ਸਕੇ ਅਤੇ ਉਹਨੂੰ ਪਤਾ ਲੱਗੇ ਕਿ ਦੁਨੀਆਂ ਵਿੱਚ ਹੋਰ ਕੀ ਚੱਲ ਰਿਹਾ ਹੈ